ਮੈਂ ਐੱਮ ਐੱਸ ਸੀ ਆਈ ਟੀ ਕੀਤੀ ਹੋਈ ਆ ਅਤੇ ਐੱਮ ਐੱਸ ਸੀ ਆਈ ਟੀ ਤੋਂ ਬਾਅਦ ਮੈਂ ਪ੍ਰੋਗਰਾਮਿੰਗ ਦਾ ਕੋਰਸ ਕਰ ਰਿਹਾ ਇਹਦੇ ਵਿੱਚ ਵੈੱਬ ਡਿਜ਼ਾਇਨਿੰਗ ਵੈੱਬ ਡਿਜਾਇਨਿੰਗ ਦੇ ਵਿੱਚ ਐੱਚ ਟੀ ਐੱਮ ਐੱਲ ਸੀ ਐੱਸ ਐੱਸ ਜਾਵਾਸਕ੍ਰਿਪਟ ਅਤੇ ਜੇ ਐੱਸ ਰਿਐਕਟ ਨੋਟਿਵ ਅਤੇ ਅ ਸਾਰੀਆ ਲੈਂਗੁਏਜ ਆ ਰਹੀਆਂ ਨੇ